ਪੰਜਾਬੀ ਸੱਭਿਆਚਾਰ ਵਿੱਚ ਭੰਗੜੇ ਦੇ ਪੰਜ ਲੋਕ ਨਾਚ ਹੁੰਦੇ ਹਨ ਭੰਗੜਾ ਗਿੱਧਾ ਝੂਮਰ ਸੰਮੀ ਲੁੱਡੀ ਇਸ ਵਿੱਚ ਪੰਜਾਬ ਆਪਣੇ ਲੋਕ ਨਾਚਾਂ ਲਈ ਮਸ਼ਹੂਰ ਹੈ ਭੰਗੜਾ ਇੱਕ ਉੱਚ ਊਰਜਾ ਵਾਲਾ ਨਾਚ ਰੂਪ ਦੇ ਜ਼ੋਰਦਾਰ ਹਰਕਤਾਂ ਅਤੇ ਤਾਲਬੱਧ ਫੁੱਟਵਰਕ ਦੁਆਰਾ ਦਰਸਾਇਆ ਜਾਂਦਾ ਹੈ ਅੰਤਰਰਾਸ਼ਟਰੀ ਮਾਨਤਾ ਪ੍ਰਾਪਤ ਹੈ ਇੱਕ ਪ੍ਰਸਿੱਧ ਨਾਚ ਗਿੱਧਾ ਹੈ ਜੋ ਕਿ ਔਰਤਾਂ ਦੁਆਰਾ ਪੇਸ਼ ਕੀਤਾ ਜਾਂਦਾ ਹੈ ਜੋ ਸੁੰਦਰਤਾ ਨੂੰ ਦਰਸਾਉਂਦਾ ਹੈ ਭੰਗੜਾ ਸਭ ਤੋਂ ਮਸ਼ਹੂਰ ਅਤੇ ਵਿਆਪਕ ਤੌਰ 'ਤੇ ਮਾਨਤਾ ਪ੍ਰਾਪਤ ਪੰਜਾਬੀ ਸੱਭਿਆਚਾਰ ਰੂਪ ਹੈ ਇਹ ਇੱਕ ਵਾ ਵਾਢੀ ਦੇ ਨਾਚ ਵਜੋਂ ਉਤਪੰਨ ਹੈ ਇੱਕ ਪ੍ਰਸਿੱਧ ਸੱਭਿਆਚਾਰਕ ਨਾਚ ਹੈ ਵਿੱਚ ਵਿਕਸਿਤ ਹੋਇਆ ਹੈ ਭੰਗੜੇ ਦੀ ਵਿਸ਼ੇਸ਼ਤਾ ਜ਼ੋਰਦਾਰ ਹਰਕਤਾਂ ਊਰਜਾਵਾਨ ਸਾਲ ਅਤੇ ਸਮਕਾਲੀ ਫੁੱਟਵਰਕ ਦੁਆਰਾ ਕੀਤਾ ਜਾਂਦਾ ਹੈ ਆਮ ਤੌਰ 'ਤੇ ਢੋਲ ਦੀਆਂ ਬੀਟਾਂ 'ਤੇ ਪੇਸ਼ ਕੀਤਾ ਜਾਂਦਾ ਹੈ ਇੱਕ ਰਿਵਾਇਤੀ ਪੰਜਾਬੀ ਢੋਲ ਮਰਦ ਆਮ ਤੌਰ 'ਤੇ ਰੰਗੀਨ ਦਸਤਾਰਾਂ ਅਤੇ ਕੁੜਤਾ ਪਜਾਮਾ ਪਹਿਨਦੇ ਹਨ ਅਤੇ ਆਪਣੀ ਤਾਕਤ ਨੂੰ ਜੀਵਨ ਸ਼ਕਤੀ ਨੂੰ ਦਰਸਾਉਂਦੇ ਹੋਏ ਸ਼ਕਤੀਸਾਲੀ ਚਾਲ ਚਲਾਉਂਦੇ ਹਨ ਗਿੱਧਾ ਇੱਕ ਪੰਜਾਬੀ ਮੁਟਿਆਰਾਂ ਲਈ ਰਿਵਾਇਤੀ ਨਾਚ ਹੈ ਜੋ ਵਿਸ਼ੇਸ਼ ਤੌਰ 'ਤੇ ਔ ਮੁਟਿਆਰਾਂ ਦੁਆਰਾ ਹੀ ਪੇਸ਼ ਕੀਤਾ ਜਾਂਦਾ ਹੈ ਇਹ ਆਪਣੀਆਂ ਸ਼ਾਨਦਾਰ ਅਤੇ ਸ਼ਾਨਦਾਰ ਹਰਕਤਾਂ ਲਈ ਜਾਣਿਆ ਜਾਂਦਾ ਹੈ ਗਿੱਧਾ ਅਕਸਰ ਲੋਹੜੀ ਅਤੇ ਤੀਜ ਵਰਗੇ ਤਿਉਹਾਰਾਂ 'ਤੇ ਦੌਰਾਨ ਜਾਂ ਤੀਆਂ ਦੇ ਤਿਉਹਾਰ 'ਤੇ ਨੱਚਣ ਲਈ ਚੱਕਰ ਬਣਾਉਂਦੇ ਹਨ ਅਤੇ ਇਸ਼ਾਰਿਆਂ ਦੇ ਚਿਹਰੇ 'ਤੇ ਹਾਵ ਭਾਵ ਦੁਆਰਾ ਭਾਵਨਾ ਨੂੰ ਪ੍ਰਗਟ ਕਰਦੇ ਹਨ ਤਾਲਬੱਧ ਤਾੜੀਆਂ ਵਿੱਚ ਸ਼ਾਮਲ ਹੁੰਦੇ ਹਨ ਨਾਚ ਲੋਕ ਗੀਤਾਂ ਦੇ ਨਾਲ ਹੀ ਹੁੰਦਾ ਹੈ ਅਤੇ ਔਰਤਾਂ ਰੰਗੀਨ ਰਿਵਾਇਤੀ ਪਹਿਰਾਵਾ ਅਪਣਾਉਂਦੀਆਂ ਹਨ ਜਿਸ ਵਿੱਚ ਜੀਵੰਤ ਸਲਵਾਰ ਕਮੀਜ਼ ਅਤੇ ਦੁਪੱਟੇ ਸਾਮਲ ਹੁੰਦੇ ਹਨ